ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਇੰਟੀਰੀਅਰ ਡਿਜ਼ਾਇਨਰ ਬੋਲ ਰਹੇ ਹੋ ਹਾਂਜੀ ਵੀਰ ਜੀ ਅਸੀਂ ਘਰ ਦੀ ਥੋੜ੍ਹੀ ਜਿਹ ਰੈਨੋਵੇਸ਼ਨ ਦਾ ਕਰਵਾਉਣਾ ਸੀ ਕੰਮ ਅਸੀਂ ਕਾਫੀ ਸਾਲ ਹੋ ਗਏ ਪੀ ਵੀ ਸੀ ਸ਼ੀਟਾ ਲਗਵਾਈਆਂ ਹੋਈਆਂ ਨੇ ਘਰ ਵਿੱਚ ਪਰ ਹੁਨ ਉਹ ਬੱਚੇ ਛੋਟੇ ਨੇ ਐਸ ਕਰਕੇ ਥੋੜ੍ਹੀਆਂ ਬਹੁਤ ਟੁੱਟੀਆਂ ਪਈਆਂ ਨੇ ਅਤੇ ਅਸੀਂ ਉਹਦੀ 'ਚ ਉਹਦੀ ਜਗ੍ਹਾ 'ਤੇ ਕੀ ਲਗਵਾ ਸਕਦੇ ਹਾਂ ਮੇਨ ਅਸੀਂ ਇੱਕ ਅੱਧਾ ਡਰਾਇੰਗ ਰੂਮ ਰੈਨੋਵੇਟ ਕਰਵਾਉਣਾ ਜੇ ਤਾਂ ਚੰਗਾ ਲੱਗਿਆ ਕੰਮ ਤਾਂ ਫਿਰ ਹੋ ਸਕਦਾ ਅਸੀਂ ਬਾਕੀ ਕਮਰਿਆਂ ਵਿੱਚ ਵੀ ਕਰਵਾ ਲਵਾਂਗੇ ਰੈਨੋਵੇਸ਼ਨ ਅੱਛਾ ਜੀ ਹਾਂਜੀ ਉਹ ਹੁਣ ਟੁੱਟੀਆਂ ਪਈਆਂ ਨੇ ਤਾਂ ਹੀ ਤੁਸੀਂ ਕਿਧਰੇ ਲਗਾਈਆਂ ਹੋਣ ਟਾਇਲਸ ਵਗੈਰਾ ਅਤੇ ਜਿਹੜੀਆਂ ਡਿਊਰੇਬਲ ਹੈਗੀਆਂ ਨੇ ਤਾਂ ਅਸੀਂ ਦੇਖ ਸਕਦੇ ਹਾਂ ਉਹਨਾਂ ਦੀ ਫੋੋਟੋਆਂ ਜਾਂ ਤੁਹਾਡੇ ਕੋਲ ਦੁਕਾਨ 'ਤੇ ਹੀ ਆ ਅਸੀਂ ਵੀਰ ਜੀ ਸ਼ਹਿਰ ਤੋਂ ਬਾਹਰ ਰਹਿੰਦੇ ਹਾਂ ਸਿਵਲ ਲਾਈਨ ਵਿੱਚ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਫਿਰ ਜਿਵੇਂ ਦਾ ਵੋਲਪੇਪਰ ਹੋਏਗਾ ਫਿਰ ਅਸੀਂ ਉਵੇਂ ਦਾ ਹੀ ਸੋਫੇ ਦੇ ਕੱਪੜੇ ਦਾ ਵੀ ਤੁਸੀਂ ਕਰਦੇ ਹੋ ਇੰਟੀਰੀਅਰ ਦਾ ਸਾਰਾ ਕੰਮ ਜਾਂ ਉਹ ਖਾਲੀ ਅੱਛਾ ਜੀ ਅਤੇ ਫਿਰ ਇੱਕ ਅਸੀਂ ਮੰਦਰ ਵੀ ਨਾਲ ਹੀ ਰੈਨੋਵੇਟ ਅੱਛਾ ਜੀ ਠੀਕ ਹੈ ਪਰਦੇ ਵਗੈਰਾ ਦਾ ਵੀ ਸਭ ਕੁਛ ਹੋਏਗਾ ਅਤੇ ਮੰਦਰ ਦੇ ਕੰਮ ਦਾ ਕਰਦੇ ਹੋ ਤੁਸੀਂ ਰੈਨੋਵੇਟ ਮੰਦਰ ਦੇ ਅਸੀਂ ਰੰਗ ਚੇਂਜ ਕਰਵਾਉਣਾ ਹੈ ਅਤੇ ਅੱਜ ਕੱਲ੍ਹ ਜਿਵੇਂ ਬੱਚੇ ਚਾਹੁੰਦੇ ਹਨ ਕੀ ਉਹਨਾਂ ਦੇ ਕਮਰੇ ਅਲੱਗ ਹੋਨ ਉਹਦੇ ਵਿੱਚ ਅੱਜ ਕੱਲ੍ਹ ਜਿਹੜੇ ਕਾਰਟੂਨ ਕਰੈਕਟਰ ਆਉਂਦੇ ਨੇ ਡੋਰੀਮੋਨ ਹੋ ਗਿਆ ਛੋਟਾ ਭੀਮ ਹੋ ਗਿਆ ਜਾਂ ਬਾਰਬੀ ਵਾਲੇ ਅਤੇ ਕਰੈਕਟਰ ਦਾ ਸਾਰਾ ਇੰਟੀਰੀਅਰ ਮਿਲੇਗਾ ਤੁਹਾਡੇ ਕੋਲੋਂ ਠੀਕ ਹੈ ਜੀ ਅਤੇ ਰੇਟ ਵਗੈਰਾ ਦੀ ਕਨਫਰਮੇਸ਼ਨ ਤੁਸੀਂ ਦੁਕਾਨ 'ਤੇ ਦਿਓਗੇ ਜਾ ਕੁਛ ਆਈਡੀਆ ਦੇ ਸਕਦੇ ਹੋ

ਠੀਕ ਹੈ ਜੀ ਠੀਕ ਹੈ ਭਾਅ ਜੀ ਫਲੋਰਿੰਗ ਦਾ ਕੰਮ ਵੀ ਹੋਏਗਾ ਤੁਹਾਡੇ ਕੋਲ ਅਸੀਂ ਹਾਲੇ ਤੱਕ ਘਰ ਦਾ ਪੱਥਰ ਬਦਲਾਉਣਾ ਨਹੀਂ ਕਮਰਿਆਂ ਦਾ ਅਤੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਉੱਤੇ ਇੱਕ ਤਰ੍ਹਾਂ ਦਾ ਮੈਟ ਜਿਹਾ ਵਿੱਛ ਜਾਵੇ ਜਿਹਦੇ ਨਾਲ ਥੋੜ੍ਹੇ ਪੰਜ ਸੱਤ ਸਾਲ ਹੋਰ ਵਧੀਆ ਨਿਕਲ ਜਾਣ ਅੱਛਾ ਜੀ ਠੀਕ ਹੈ ਚਲੋ ਠੀਕ ਹੈ ਭਾਅ ਜੀ ਫਿਰ ਅਸੀਂ ਤੁਹਾਨੂੰ ਆ ਕੇ ਮਿਲਦੇ ਹਾਂ ਤੁਸੀਂ ਆਪਦੀ ਲੋਕੇਸ਼ਨ ਭੇਜ ਦਿਓ ਦੁਕਾਨ ਦਾ ਪਤਾ ਨਹੀਂ ਹੈਗਾ ਇਹ ਤਾਂ ਉਹ ਓਨਲਾਈਨ ਹੀ ਵੇਖਿਆ ਸੀ ਤੁਹਾਡਾ ਅਸੀਂ ਠੀਕ ਹੈ ਜੀ ਐਸ ਨੰਬਰ 'ਤੇ ਹੀ ਭੇਜ ਦਿਓ ਹਾਂਜੀ ਠੀਕ ਹੈ ਜੀ ਧੰਨਵਾਦ ਜੀ